ਹਾਂਜੀ ਮੈਂ ਆਪਣੇ ਆਸ ਪਾਸ ਦੇ ਯੂਨੀਵਰਸਿਟੀ ਕੋਲਜਾਂ ਵਿੱਚ ਬਹੁਤ ਸਾਰੀਆਂ ਲਾਈਬ੍ਰੇਰੀਆਂ ਦੇਖਦਾ ਹਾਂ ਅਤੇ ਜੇਕਰ ਮੈਂ ਆਪਣੀ ਨਿੱਜੀ ਲਾਈਬ੍ਰੇਰੀ ਦੀ ਗੱਲ ਕਰਾਂ ਤਾਂ ਹਾਂ ਸਾਡੇ ਘਰ ਵੀ ਇੱਕ ਨਿੱਜੀ ਲਾਈਬ੍ਰੇਰੀ ਹੈ ਜਿਸ ਵਿੱਚ ਕਿ ਮੈਂ ਕ੍ਰਾਂਤੀਕਾਰੀ ਲੋਕਾਂ ਨਾਲ ਜੁੜੀਆਂ ਬਹੁਤ ਸਾਰੀਆਂ ਕਿਤਾਬਾਂ ਦਾ ਭੰਡਾਰ ਇਕੱਠਾ ਕੀਤਾ ਹੋਇਆ ਹੈ ਅਤੇ ਮੈਂ ਇਹਨਾਂ ਲੋਕਾਂ ਨੂੰ ਪੜ੍ਹਨਾ ਬਹੁਤ ਹੀ ਜ਼ਿਆਦਾ ਪਸੰਦ ਕਰਦਾ ਹਾਂ